ਕਿਤਾਬਾਂ ਤਾਂ ਕਾਫੀ ਪੜ੍ਹੀਆਂ ਨੇ ਜ਼ਿਆਦਾਤਰ ਕਿਤਾਬਾਂ ਯਥਾਰਥ ਬਾਰੇ ਪੜ੍ਹੀਆਂ ਪਰ ਕੁਝ ਕਿਤਾਬਾਂ ਮੈਨੂੰ ਜ਼ਿੰਦਗੀ ਦੇ ਅੰਦਰੋਂ ਸਕੂਨ ਦਿੰਦੀਆਂ ਨੇ ਉਹਨਾਂ ਦੇ ਵਿੱਚ ਸੰਤ ਮਸਕੀਨ ਸਿੰਘ ਜੀ ਦੀ ਕਿਤਾਬ ਹੈ ਸੰਤ ਮਸਕੀਨ ਸਿੰਘ ਜੀ ਸ਼੍ਰੋਮਣੀ ਸੰਤ ਹੋਏ ਆ ਪੰਜਾਬ ਦੇ ਬਹੁਤ ਲੋਕ ਉਹਨਾਂ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਨੂੰ ਸੁਣ ਕੇ ਪਰਮਾਤਮਾ ਦਾ ਰੱਬੀ ਰੂਹ ਦਾ ਧਿਆਨ ਧਰਦੇ ਨੇ ਉਹਨਾਂ ਦੀਆਂ ਦੋ ਤਿੰਨ ਕਿਤਾਬਾਂ ਮੈਂ ਲੈ ਕੇ ਆਇਆ ਸੀ ਉਹਨਾਂ 'ਚੋਂ ਇੱਕ ਕਿਤਾਬ ਹੈ ਪੰਜ ਤੱਤ ਪੰਜ ਤੱਤ ਜਦੋਂ ਮੈਂ ਕਿਤਾਬ ਪੜ੍ਹੀ ਤਾਂ ਮੈਨੂੰ ਧਿਆਨ ਹੋਇਆ ਵੀ ਇਹ ਸਰੀਰ ਸਿਰਫ ਫਿਜੀਕਲ ਸਰੀਰ ਨਹੀਂ ਹੈਗਾ ਭੌਤਿਕ ਸਰੀਰ ਨਹੀਂ ਹੈਗਾ ਉਸ ਕਿਤਾਬ ਦੇ ਜੋ ਤਤਕਰਾ ਦੇਖਦੇ ਹਾਂ ਸੂਚੀ ਦੇਖਦੇ ਹਾਂ ਉਹਦੇ ਵਿੱਚ ਕਈ ਵਿਸ਼ੇ ਹੈ ਪਹਿਲਾ ਵਿਸ਼ਾ ਸਰੀਰ ਕੀ ਹੈ ਇਹ ਸਰੀਰ ਸਿਰਫ ਮਿੱਟੀ ਦਾ ਨਹੀਂ ਬਣਿਆ ਇਹ ਸਰੀਰ ਦੇ ਵਿੱਚ ਪੰਜ ਸਰੀਰ ਹੋਰ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਸਰੀਰ ਜਿਹੜਾ ਬਾਹਰਲਾ ਸਰੀਰ ਹੈ ਇਹ ਸਿਰਫ ਅੰਨ ਨਾਲ ਪਾਲਦਾ ਜਿਹੜਾ ਮਨ ਹੈ ਉਹ ਮਨ ਵਿਚਾਰਾਂ ਨਾਲ ਪਲ ਦਾ ਇਸ ਕਰਕੇ ਇਸ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਉਹ ਉਹਨਾਂ ਨੇ ਦੱਸਿਆ ਸੀ ਵੀ ਅੰਨ ਦੀ ਲੋੜ ਹੈ ਪਾਣੀ ਦੀ ਲੋੜ ਹੈ ਫਿਰ ਉਹਨੇ ਕਿਹਾ ਜੇ ਤੁਹਾਡਾ ਮਨ ਹੈ ਮਨ ਤੁਹਾਡਾ ਕਦੇ ਨਹੀਂ ਮਰਦਾ ਮਨ ਦਾ ਰਸਤਾ ਬਦਲਿਆ ਜਾ ਸਕਦਾ ਮਨ ਨੂੰ ਕੁਝ ਚਿਰ ਲਈ ਸ਼ਾਂਤ ਕਰਾਇਆ ਜਾ ਸਕਦਾ ਉਹਨਾਂ ਨੇ ਦੱਸਿਆ ਸੀ ਵੀ ਮਨ ਦੀ ਖੁਰਾਕ ਸ਼ਬਦ ਹੈ ਭਜਨ ਹੈ ਧਿਆਨ ਹੈ ਉਹਨਾਂ ਨੇ ਕਿਹਾ ਵੀ ਜਦੋਂ ਸਾਡੀਆਂ ਸਰੀਰਕ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਫਿਰ ਵੀ ਸਾਨੂੰ ਸੁੱਖ ਕਿਉਂ ਨਹੀਂ ਮਿਲਦਾ ਕਿਉਂਕਿ ਸਾਡਾ ਮਨ ਭਟਕਦਾ ਰਹਿੰਦਾ ਮਨ ਨੂੰ ਸ਼ਾਂਤ ਕਰਨ ਵਾਸਤੇ ਸਾਨੂੰ ਧਿਆਨ ਲਾਉਣਾ ਚਾਹੀਦਾ ਬਹੁਤ ਵਧੀਆ ਉਹਨਾਂ ਨੇ ਡੂੰਘੀਆਂ ਗੱਲਾਂ ਇਸ ਸਰੀਰ ਬਾਰੇ ਦੱਸੀਆਂ ਨੇ ਪੰਜ ਤੱਤਾਂ ਉਸ ਕਿਤਾਬ ਦਾ ਵਿਸ਼ਾ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹੀ ਆ ਵੀ ਆਤਮਾ ਨਾ ਜਿਹੜੀ ਆਤਮਾ ਆਤਮਾ ਨੂੰ ਬਲਵਾਨ ਬਣਾਉਣਾ ਚਾਹੀਦਾ ਬੜੀ ਘੱਟੋ ਘੱਟ ਚਾਲ੍ਹੀ ਪੇਜਾਂ ਦੀ ਉਹ ਕਿਤਾਬ ਹੈ ਅਤੇ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਗੱਲ ਕਹੀ ਹੈ ਫਿਰ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਬੰਦੇ ਰੋਜ਼ ਮਨ ਖੋਜ ਬੰਦੇ ਹਰ ਰੋਜ਼ ਮਨ ਖੋਜ ਵੀ ਹੇ ਬੰਦੇ ਤੂੰ ਹਰ ਰੋਜ਼ ਆਪਣੇ ਮਨ ਨੂੰ ਖੋਜ ਆਪਣੇ ਮਨ ਨੂੰ ਇਕਾਗਰ ਕਰ ਕਿਉਂਕਿ ਆਪਾਂ ਨੂੰ ਕਿਤਾਬਾਂ ਦੇ ਵਿੱਚ ਦੱਸਿਆ ਗਿਆ ਮਨ ਜਿੱਤੇ ਜਗ ਜੀਤ ਜਿਹੜੇ ਮਨ ਜਿੱਤਿਆ ਜਗ ਜਿੱਤਿਆ ਇਹ ਸਰੀਰਕ ਲੋੜਾਂ ਬਾਹਰਲੀਆਂ ਗੱਡੀ ਏਸੀ ਭੌਤਿਕ ਲੋੜਾਂ ਨੇ ਪਰ ਇਸ ਤੋਂ ਬਾਅਦ ਵੀ ਜਿਹੜੇ ਅੰਦਰੂਨੀ ਸ਼ਾਂਤੀ ਵਾਸਤੇ ਉਹਨਾਂ ਨੇ ਦੱਸਿਆ ਵੀ ਆਪਣੇ ਮਨ ਨੂੰ ਮਜ਼ਬੂਤ ਕਰੋ ਆਪਣੀ ਆਤਮਾ ਨੂੰ ਮਨਜੂਤ ਮਜ਼ਬੂਤ ਕਰੋ ਇਸ ਕਰਕੇ ਉਹਨਾਂ ਦੀ ਉਹ ਕਿਤਾਬ ਮੈਨੂੰ ਸ ਬਹੁਤ ਵਧੀਆ ਲੱਗਦੀ ਆ ਹੁਣ ਵੀ ਜਦੋਂ ਸਮਾਂ ਮਿਲਦਾ ਮੇਰੇ ਸਿਰਹਾਣੇ ਪਈ ਹੁੰਦੇ ਆ ਬੈਡ ਦੇ ਤੋ ਮੈਂ ਕਿਤਾਬ ਪੜ੍ਹ ਕੇ ਦੇਖਦਾ ਜਦੋਂ ਮੇਰਾ ਮਨ ਅਸ਼ਾਂਤ ਹੁੰਦਾ ਅਤੇ ਮੈਂ ਉਸ ਕਿਤਾਬ ਦੇ ਕੁਛ ਪੰਨੇ ਪੜ੍ਹਦਾ ਤਾਂ ਜੋ ਮੈਂ ਆਪਣੇ ਆਪ ਨੂੰ ਅਸਲੀ ਤੌਰ 'ਤੇ ਪਹਿਚਾਣ ਸਕਾਂ